ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਰਿੰਦਰ ਜੀ ਗੱਲ ਰਹੇ ਹੋ ਜੀ ਜੀ ਜੀ ਮੈਂ ਮੈਂ ਅਭਿਸ਼ੇਕ ਗੱਲ ਰਿਹਾ ਬੁਲਾਢੇ ਤੋਂ ਗੱਲ ਰਿਹਾ ਜੀ ਤੁਹਾਡੇ ਤੁਹਾਡੇ ਹਲਕੇ ਤੋਂ ਗੱਲ ਕਰ ਰਿਹਾ ਜੀ ਮੈਂ ਹਿੰਮਤਪੁਰਾ ਤੋਂ ਗੱਲ ਰਿਹਾ ਜੀ

ਹਾਂਜੀ ਹਾਂਜੀ ਤਾਂ ਕਰਕੇ ਮੈਂ ਤੁਹਾਨੂੰ ਕਾਲ ਲਾਈ ਸੀ ਇੱਕ ਆਪਣਾ ਗਲੀ 'ਚ ਪਾਣੀ ਭਰਿਆ ਰਹਿੰਦਾ ਹੈ ਹਾਂ ਅਤੇ ਦੂਜਾ ਫਿਰ ਪਾਣੀ ਵੀ ਦੋ ਦਿਨ ਤਿੰਨ ਦਿਨ ਛੱਡ ਕੇ ਆਉਂਦਾ ਹੈ ਤਾਂ ਫਿਰ ਜੋ ਪਾਣੀ ਅਉਂਦਾ ਹੈ ਉਹ ਵੀ ਬੜਾ ਬੇਕਾਰ ਹੈਗਾ ਸਾਫ ਨਹੀਂ ਹੈਗਾ ਦੇਖੋ ਦੇਖੋ ਭਾਈ ਜੀ ਭਾਈ ਜੀ ਮੇਰੀ ਗੱਲ ਸੁਣੋ ਤੁਸੀਂ ਅਸੀਂ ਅਸੀਂ ਅਸੀਂ ਅਸੀਂ ਅਸੀਂ ਅਸੀਂ ਤੁਹਾਨੂੰ ਵੋਟ ਦਿੱਤੇ ਆ ਤਾਂ ਤੁਸੀਂ ਕੰਮ ਤਾਂ ਕਰੋ ਕੁੱਛ ਵੋਟਾਂ ਦੇ ਵੇਲ਼ੇ ਤੁਸੀਂ ਆ ਜਾਂਦੇ ਹੋ ਹੱਥ ਜੋੜ ਜੋੜ ਕੇ

ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ

ਹਾਂਜੀ ਮਾੜਾ ਜਾ ਛੇਤੀ ਕੰਮ ਕਰਾ ਦਿਓ ਫਿਰ ਅੱਗਲੀ ਵਾਰੀ ਅੱਗਲੀ ਵਾਰੀ ਵੀ ਦੇਖਿਓ ਤੁਹਾਨੂੰ ਹੀ ਵੋਟ ਪਾਓਣੀ ਅਸੀਂ ਚੰਗਾ ਜੀ ਚੰਗਾ ਜੀ ਧੰਨਵਾਦ ਜੀ ਧੰਨਵਾਦ